ਅਸੀਂ ਵੱਖ ਵੱਖ ਕਹਾਣੀਆਂ ਜੀਵਨੀਆਂ ਨਾਟਕਾਂ ਕਵਿਤਾਵਾਂ ਨਾਵਲਾਂ ਆਦਿ ਨੂੰ ਪੜ੍ਹ ਕੇ ਉਨ੍ਹਾਂ ਨੂੰ ਸਮਝ ਕੇ ਆਪਣੀ ਲਿਖਿਤ ਵਿੱਚ ਵਿਭਿੰਨ ਵਿਸ਼ਵ ਵਿੱਚ ਸਾਹਿਤਿਕ ਪਰੰਪਰਾਵਾਂ ਦੇ ਤੱਤਾਂ ਨੂੰ ਸ਼ਾਮਿਲ ਕਰ ਸਕਦੇ ਹਾਂ ਭਾਰਤ ਦੀ ਸਾਹਿਤਿਕ ਪ੍ਰੰਪਰਾ ਲਗਪਗ ਚਾਰ ਹਜ਼ਾਰ ਸਾਲਾਂ ਤੋਂ ਵੀ ਪੁਰਾਣੀ ਹੈ ਇਸ ਦੌਰਾਨ ਸੰਸਕ੍ਰਿਤ ਦੀ ਪ੍ਰਧਾਨਤਾ ਸੀ ਮੇਰੇ ਜੀਵਨ ਵਿੱਚ ਬਹੁਤ ਸਾਰੇ ਸਾਹਿਤਕਾਰਾਂ ਨੇ ਪ੍ਰਭਾਵ ਪਾਇਆ ਹੈ ਜਿਨ੍ਹਾਂ ਨਾਲ ਮੇਰੀ ਲਿਖਿਤ ਬਹੁਤ ਅਮੀਰ ਹੋਈ ਹੈ ਬਹੁਤ ਸਾਰੇ ਸਾਹਿਤਕਾਰ ਜਿਸ ਤਰ੍ਹਾਂ ਰ ਰਵਿੰਦਰ ਨਾਥ ਟੈਗੋਰ ਸ਼ੇਕਸਪੀਅਰ ਭਾਈ ਵੀਰ ਸਿੰਘ ਜੀ ਰਵਿੰਦਰ ਨਾਥ ਟੈਗੋਰ ਜੀ ਦੀ ਲਿਖਿਤ ਹੈ ਕਿ ਜਦੋਂ ਅਸੀਂ ਹਲੀਮੀ ਨਾਲ ਲੋਕਾਂ ਨਾਲ ਮਿਲਦੇ ਹਾਂ ਤਾਂ ਅਸੀਂ ਉਸ ਸਮੇਂ ਆਪਣੀ ਮਹਾਨਤਾ ਦੇ ਨਜ਼ਦੀਕ ਹੁੰਦੇ ਹਾਂ ਇਸ ਤੋਂ ਇਲਾਵਾ ਆਸਥਾ ਇੱਕ ਇੱਦਾਂ ਦਾ ਪੰਛੀ ਹੈ ਜੋ ਤੜਕੇ ਦੇ ਅੰਧੇਰੇ ਵਿੱਚ ਵੀ ਰੌਸ਼ਨੀ ਫੈਲਾ ਦਿੰਦਾ ਹੈ ਯਾਨੀ ਕਿ ਤੜਕੇ ਦੇ ਅੰਧੇਰੇ ਨੂੰ ਵੀ ਰੋਸ਼ਨੀ ਵਿੱਚ ਬਦਲ ਦਿੰਦਾ ਹੈ ਇਸ ਤੋਂ ਇਲਾਵਾ ਸ਼ੇਕਸਪੀਅਰ ਜੀ ਨੇ ਕਿਹਾ ਹੈ ਸ਼ੇਕਸਪੀਅਰ ਜੀ ਕਹਿੰਦੇ ਹਨ ਕਿ ਕੁਝ ਵੀ ਚੰਗਾ ਜਾਂ ਬੁਰਾ ਨਹੀਂ ਹੁੰਦਾ ਸੋਚ ਹੁੰਦੀ ਹੈ ਜੋ ਕਿਸੇ ਵੀ ਚੀਜ਼ ਨੂੰ ਚੰਗਾ ਜਾਂ ਮਾੜਾ ਬਣਾਉਂਦੀ ਹੈ ਇਸ ਤੋਂ ਇਲਾਵਾ ਇਨ੍ਹਾਂ ਨੇ ਕਿਹਾ ਹੈ ਕਿ ਇਸ ਤੋਂ ਇਲਾਵਾ ਇਨ੍ਹਾਂ ਨੇ ਰਿਸ਼ਤਿਆਂ ਸੰਬੰਧੀ ਉਲਝਣਾਂ ਦੀ ਵਿਆਖਿਆ ਕੀਤੀ ਹੈ ਇਸ ਤੋਂ ਇਲਾਵਾ ਭਾਈ ਵੀਰ ਸਿੰਘ ਜੀ ਇੱਕ ਮਹਾਨ ਪੰਜਾਬ ਦੇ ਮਹਾਨ ਸਾਹਿਤਕਾਰ ਸਨ ਇਨ੍ਹਾਂ ਨੇ ਸਿੱਖੀ ਦੀ ਮਹਾਨਤਾ ਨੂੰ ਦਰਸਾਇਆ ਹੈ ਇਨ੍ਹਾਂ ਨੇ ਸਾਨੂੰ ਹੰਕਾਰ ਜਾਂ ਆਕੜ ਤੋਂ ਦੂਰ ਰਹਿਣ ਲਈ ਕਿਹਾ ਹੈ ਸੋ ਇਸ ਤਰ੍ਹਾਂ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਸਾਹਿਤਕਾਰ ਹਨ ਜਿਨ੍ਹਾਂ ਨਾਲ ਮੇਰੀ ਜਿੰਦਗੀ ਵਿੱਚ ਬਹੁਤ ਪ੍ਰਭਾਵ ਪਿਆ ਹੈ ਅਤੇ ਮੇਰੀ ਲਿਖਿਤ ਬਹੁਤ ਅਮੀਰ ਹੋਈ ਹੈ ਅਤੇ ਮੈਨੂੰ ਇਨ੍ਹਾਂ 'ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ